ਹੈਲੋ ਫਲਿੱਪਡ ਫਕਲਟੀ ਤੋਂ ਗੱਲ ਕਰਦੇ ਪਏ ਹੋ ਮੈਂ ਨਾ ਥੋੜ੍ਹੇ ਦਿਨ ਪਹਿਲਾਂ ਇੱਕ ਔਡਰ ਬੋਟ ਦੀ ਬੋਟ ਵੇਵ ਮੋਡਲ ਨੰਬਰ ਦੀ ਔਡਰ ਵਾਚ ਕੀਤੀ ਸੀਗੀ ਅਤੇ ਪਰ ਉਹ ਮੈਨੂੰ ਜਿਹੜਾ ਪ੍ਰੋਡਕਟ ਸੀਗਾ ਉਹ ਗਲਤ ਮਿਲਿਆ ਹੋਇਆ ਵਾ ਅਤੇ ਬਟ ਮੈਂ ਫਿਰ ਵੀ ਕੋਈ ਤੁਹਾਨੂੰ ਕੀਤਾ ਨਹੀਂ ਆ ਕੰਪਲੇਂਟ ਵਗੈਰਾ ਨਹੀਂ ਕੀਤੀ ਸੀਗੀ ਅਤੇ ਉੱਤੋਂ ਮੈਨੂੰ ਮਿਲੀ ਵੀ ਵੋਚ ਜਿਹੜੀ ਵੋਚ ਮਿਲੀ ਸੀਗੀ ਉਹ ਲੇਟ ਮਿਲੀ ਸੀਗੀ ਅਤੇ ਮੈਂ ਪਾਰਟੀ ਵਗੈਰਾ 'ਤੇ ਵੇਅਰ ਕਰਨੀ ਸੀਗੀ ਉਹਨੂੰ ਅਤੇ ਮੈਂ ਉਹ ਪਾਰਟੀ 'ਤੇ ਵੀ ਨਹੀਂ ਵੇਅਰ ਕਰ ਸਕਿਆ ਅਤੇ ਮੈਂ ਉਸ 'ਤੇ ਵੀ ਤੁਹਾਨੂੰ ਕੋਈ ਕੰਪਲੇਂਟ ਵਗੈਰਾ ਨਹੀਂ ਸੀ ਕੀਤੀ ਮੈਂ ਕਿਹਾ ਚਲੋ ਕੋਈ ਨਹੀਂ ਬੰਦੇ ਕੋਲੋਂ ਹੋ ਹੀ ਜਾਂਦਾ ਇੱਧਰ ਉੱਧਰ ਅਤੇ ਹੋ ਜਾਂਦੀ ਹੈ ਇੱਕ ਚੀਜ਼ ਅਤੇ ਬਟ ਹੁਣ ਦੋ ਕੁ ਤਿੰਨ ਦਿਨ ਬਾਅਦ ਚੱਲਣ ਤੋਂ ਬਾਅਦ ਇਹ ਵੋਚ ਆਪਣੇ ਆਪ ਹੀ ਚੱਲਦੀ ਚੱਲਦੀ ਬੰਦ ਹੋ ਗਈ ਹੈ ਅਤੇ ਮੈਂ ਇਹਨੂੰ ਚਾਰਜਿੰਗ ਵੀ ਲਾ ਕੇ ਰੱਖਿਆ ਸੀਗਾ ਅਤੇ ਬਟ ਇਹ ਚੱਲੀ ਨਹੀਂ ਆ ਚੱਲੀ ਨਹੀਂ ਆ ਅਤੇ ਬਟ ਮੈਂ ਫਿਰ ਵੀ ਤੁਹਾਨੂੰ ਹੁਣ ਲਿਖ ਰਿਹਾ ਵਾਂ ਕਿ ਇਹ ਵੋਚ ਤੁਹਾਡੀ ਬਹੁਤ ਹੀ ਖਰਾਬ ਹੈਗੀ ਆ ਅਤੇ ਪਤਾ ਨਹੀਂ ਤੁਸੀਂ ਮੈਨੂੰ ਕਿਉਂ ਐਨਾ ਗਲਤ ਪ੍ਰੋਡਕਟ ਭੇਜ ਦਿੱਤਾ ਹੋਇਆ ਵਾ ਅਤੇ ਹੁਣ ਇਸ 'ਤੇ ਮੈਂ ਆਪਣੀ ਆਪਣੀ ਬੈਡ ਰੇਟਿੰਗ ਵੀ ਤੁਹਾਨੂੰ ਦਿਆਂਗਾ ਜੀਰੋ ਸਟਾਰ ਤੁਹਾਨੂੰ ਮੈਂ ਆਪਣੇ ਉਹ 'ਤੇ ਫਲਿੱਪਕਾਰਡ 'ਤੇ ਦਿਆਂਗਾ ਅਤੇ ਦੀਵਿਊ ਵਿੱਚ ਕਮੈਂਟ ਸੈਕਸ਼ਨ ਵਿੱਚ ਇਹ ਵੀ ਲਿਖਾਂਗਾ ਕਿ ਇਹ ਤੁਹਾਡਾ ਪ੍ਰੋਡਕਟ ਬਿਲਕੁਲ ਵੀ ਵਧੀਆ ਨਹੀਂ ਹੈਗਾ ਅਤੇ ਕਿਸੇ ਨੂੰ ਵੀ ਇਸ 'ਤੇ ਪੈਸੇ ਖਰਾਬ ਕਰਨ ਦੀ ਜ਼ਰੂਰਤ ਨਹੀਂ ਹੈਗੀ